ਭਾਰਤ ਵਿੱਚ ਮਹਿਲਾਵਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਅਸੀਂ ਘਰ ਤੋਂ ਹੀ ਅਗਰ ਸ਼ੁਰੂ ਹੋ ਜਾਈਏ ਤਾਂ ਸਭ ਤੋਂ ਪਹਿਲਾਂ ਤਾਂ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਿਵੇਂ ਹੀ ਉਹ ਘਰ ਤੋਂ ਬਾਹਰ ਨਿਕਲਦੀਆਂ ਹਨ ਤਾਂ ਉਹਨਾਂ ਦੇ ਮੂਹਰੇ ਇੱਕ ਸਭ ਤੋਂ ਵੱਡੀ ਚੁਣੌਤੀ ਆ ਖੜੀ ਹੋ ਜਾਂਦੀ ਹੈ ਜੋ ਕਿ ਹੈ ਈਵ ਟੀਜ਼ਿੰਗ ਦੀ ਮਹਿਲਾਵਾਂ ਦੇ ਨਾਲ ਛੇੜ ਛਾੜ ਪਬਲਿਕ ਪਲੇਸਿਸ ਦੇ ਉੱਤੇ ਇੱਕ ਬਹੁਤ ਹੀ ਆਮ ਜੀ ਗੱਲ ਹੈ ਜਿਹੜੀ ਕਿ ਸਾਨੂੰ ਦੇਖਣ ਨੂੰ ਮਿਲਦੀ ਹੈ ਅਗਰ ਅਸੀਂ ਇਸ ਤੋਂ ਅੱਗੇ ਵਧੀਏ ਤਾਂ ਉਹ ਜਿੱਥੇ ਵੀ ਕੰਮ ਕਰਦੀਆਂ ਹਨ ਉੱਥੇ ਵੀ ਉਹਨਾਂ ਦੇ ਨੂੰ ਭੇਦਭਾਵ ਜਿਹੜਾ ਕਿ ਮਹਿਸੂਸ ਕਰਨਾ ਪੈਂਦਾ ਹੈ ਜਿਵੇਂ ਕਿ ਹਮੇਸ਼ਾ ਉਹਨਾਂ ਨੂੰ ਉਹਨਾਂ ਦੇ ਜਿਹੜੇ ਮੇਲ ਕਲੀਗਸ ਹੁੰਦੇ ਨੇ ਉਹਨਾਂ ਦੇ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ ਪਰ ਫ਼ਿਰ ਵੀ ਜਿਹੜੀਆਂ ਕੁੜੀਆਂ ਨੇ ਇਹਨਾਂ ਸਭ ਮੁਸ਼ਕਿਲਾਂ ਨੂੰ ਚੁਣੌਤੀਆਂ ਨੂੰ ਪਿੱਛੇ ਛੱਡਦੇ ਹੋਏ ਬਹੁਤ ਤਰੱਕੀ ਕਰ ਰਹੀਆਂ ਹਨ ਉਹਨਾਂ ਨੂੰ ਸਿੱਖਿਆ ਅਤੇ ਜੌਬ ਦੇ ਵਿੱਚ ਜਦੋਂ ਬਰਾਬਰ ਔਪਰਚਿਊਨੀਟੀ ਦਿੱਤੀ ਜਾਂਦੀ ਹੈ ਤਾਂ ਕੁੜੀਆਂ ਆਪਣੀ ਕਾਬੀਲੀਅਤ ਖੂਬ ਚੰਗੀ ਤਰ੍ਹਾਂ ਦਿਖਾਉਂਦੀਆਂ ਹਨ ਅਤੇ ਹਰ ਜਗ੍ਹਾਂ 'ਤੇ ਜਿਹੜੀਆਂ ਕੁੜੀਆਂ ਨੇ ਬਾਜ਼ੀ ਮਾਰਦੀਆਂ ਹਨ ਪਰ ਫ਼ਿਰ ਵੀ ਸਾਨੂੰ ਜਿਹੜਾ ਸਮਾਜ ਆ ਉਸਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਕਿਉਂਕਿ ਕੁੜੀਆਂ ਅੱਜ ਕੱ ਅੱਜ ਤੱਕ ਵੀ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ